ਜਿਵੇਂ ਕਿ ਕੋਈ ਮੈਂ ਇੱਕ ਚੀਜ਼ ਮੰਗਵਾਈ ਸੀ ਜਿਵੇਂ ਮਲੇਰਕੋਟਲੇ ਤੋਂ ਕਹੀ ਮੰਗਵਾਈ ਸੀ ਅਤੇ ਉਹਦਾ ਬਾਹਾ ਥੋੜ੍ਹਾ ਜਿਹਾ ਗਿੱਲਾ ਸੀ ਉਹ ਥੋ ਟੇਢਾ ਹੋ ਗਿਆ ਅਤੇ ਬੈਲਡਿੰਗ ਵੀ ਟੁੱਟ ਗਈ ਅਤੇ ਵਧੀਆ ਲੋਹਾ ਨਹੀਂ ਨਿਕਲਿਆ ਜਦੋਂ ਅਸੀਂ ਉਹਨੂੰ ਚਲਾਉਂਦੇ ਹਾਂ ਤਾਂ ਕੋਈ ਰੋੜਾ ਮੂਹਰੇ ਆ ਜਾਂਦਾ ਹੈ ਤਾਂ ਉਹ ਮੁੜ ਜਾਂਦੀ ਹੈ ਤਾਂ ਸਾਨੂੰ ਉਹਨੂੰ ਫਿਰ ਸਿੱਧਾ ਕਰਨਾ ਪੈਂਦਾ ਏ ਅਤੇ ਉਹ ਵਧੀਆ ਤਰੀਕੇ ਨਾਲ ਚੱਲਦੀ ਨਹੀਂ ਕਿਉਂਕਿ ਸਾਨੂੰ ਇਸ ਮੰਗਵਾਉਣ ਦੇ ਵਿੱਚ ਬਹੁਤ ਘਾਟਾ ਪਿਆ ਏ ਜਿਵੇਂ ਕਿ ਉਹ ਸਾਡੇ ਕੰਮ ਦੇ ਵਿੱਚ ਵੀ ਖੜਤ ਪੈਂਦੀ ਹੈ ਅਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਵਰਤ ਸਕੇ ਕਿ ਲੋਹਾ ਬਹੁਤ ਮਾੜਾ ਸੀ ਅਤੇ ਸਾਡਾ ਜਿਹੜਾ ਉਹ ਬਾਹਾ ਪਾਇਆ ਹੋਇਆ ਸੀ ਉਹ ਵੀ ਸਾਨੂੰ ਜਿਵੇਂ ਉਹ ਕਹਿੰਦੇ ਤੇ ਉਹ ਤਾਂ ਕਿੱਕਰ ਦਾ ਪਾਇਆ ਹੋਇਆ ਸਾਡੇ ਪਰ ਉਹ ਵਧੀਆ ਨਹੀਂ ਸੀ ਪਾਇਆ ਵਾ ਇਸ ਕਰਕੇ ਉਹ ਸਾਨੂੰ ਕਹੀ ਚੰਗੀ ਨਹੀਂ ਲੱਗੀ